ਸਾਡੇ ਖੇਤਰ ਵਿੱਚ ਮੁੱਖ ਭਾਸ਼ਾਵਾਂ ਬ ਬੋਲੀਆਂ ਜਾਂਦੀਆਂ ਹਨ ਆਮ ਤੌਰ 'ਤੇ ਮਤਲਬ ਪੰਜਾਬ ਹਰਿਆਣਾ ਉਹ ਕਈ ਇਲਾਕਿਆਂ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿਵੇਂ ਕਿ ਗੁਜਰਾਤ ਵਿੱਚ ਉਸ ਤਰ੍ਹਾਂ ਦੀ ਭਾਸ਼ਾ ਬੋਲੀ ਜਾਦੀ ਸਾਡੀਆਂ ਮੁੱਖ ਭਾਸ਼ਾਵਾਂ ਉਹ ਪੁ ਮਾਝੀ ਬ ਮਲਵਈ ਪੁਆਧੀ ਮਤਲਬ ਕ ਹ ਇਲਾਕੇ ਵਿੱਚ ਬਹੁਤ ਤਰ੍ਹਾਂ ਦੀਆਂ ਹੀ ਭਾਸ਼ਾ ਬੋਲੀ ਹ ਅਲੱਗ ਅਲੱਗ ਤਰ੍ਹਾਂ ਇਲਾਕਿਆਂ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮੁੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਸ ਸਾਨੂੰ ਇਹ ਮਾਣ ਮਹਿਸੂਸ ਹੈ ਕਿ ਸਾਡੇ ਪੰਜਾ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਕਿ ਮਾਝੀ ਅਤੇ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਅਤੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੀ ਪੰ ਮਾਤ ਭਾਸ਼ਾ ਮਤਲਬ ਭਾਵ ਪੰਜਾਬੀ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਪੰਜਾਬੀ ਹੋਣ ਦਾ ਮਾਣ ਮਿਲਿਆ ਹੈ ਅਤੇ ਇਸ ਲਈ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਕਿ ਮਾਝੀ ਅਤੇ ਦੁਆਬੀ ਪੁਆਧੀ ਅ ਇਸ ਤਰ੍ਹਾਂ ਦੀਆਂ ਕਈ ਭਾਸ਼ਾਵਾਂ ਮਤਲਬ ਅ ਲੋਕ ਰਹਿੰਦੇ ਹਨ ਇਸ ਤਰ੍ਹਾਂ ਦੇ ਹੋਰ ਅਲੱਗ ਅਲੱਗ ਪਹਿਰਾਵੇ ਦੇ ਅਲੱਗ ਅਲੱਗ ਕਿੱਤਿਆਂ ਦੇ ਲੋਕ ਰਹਿੰਦੇ ਹਨ ਅਤੇ ਉਹ ਆਪਣੀ ਹੀ ਭਾਸ਼ਾ ਵਿੱਚ ਗੱਲ ਕਰਦੇ ਹਨ ਅਤੇ ਪੰਜਾਬ ਵਿੱਚ ਆ ਕੇ ਪੰਜਾਬੀ ਤਰ੍ਹਾਂ ਦੀ ਇਹ ਲੋਕ ਮਤਲਬ ਭਾਸ਼ਾ ਬੋਲੀ ਜਾਂਦੀ ਹੈ ਅਤੇ ਉਸਨੂੰ ਮਾਤ ਭਾਸ਼ਾ ਕਹਿੰਦੇ ਹਾਂ ਸਾਡੀ ਮਾਤ ਭਾਸ਼ਾ ਜਿਵੇਂ ਕਿ ਮਾਝੀ ਆ ਮਲਵਈ ਆ ਇਸ ਤਰ੍ਹਾਂ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਸਾਡੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਭਾਵ ਕਿ ਮਤਲਬ ਵੱਖ ਵੱਖ ਤਰ੍ਹਾਂ ਖੇਤਰਾਂ ਵਿੱਚ ਵੱਖ ਵੱਖ ਮਤਲਬ ਇਲਾਕਿਆਂ ਵਿੱਚ ਮਤਲਵ ਅ ਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਭਾਸ਼ਾ ਬੋਲੀਆਂ ਜਾਂਦੀਆਂ ਹਨ ਅਤੇ ਉਹ ਉਹਨਾਂ ਨੂੰ ਆਪਣੀ ਮਤਲਬ ਭਾਸ਼ਾ 'ਤੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਸਾਡੇ ਨੌਜਵਾਨ ਪੀੜ੍ਹੀ ਨੂੰ ਮਤਲਬ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਪੰਜਾਬੀ ਹੋਣ 'ਤੇ ਮਾਣ ਹੈ ਇਸ ਤਰ੍ਹਾਂ ਹੀ ਸਾਨੂੰ ਪੰਜਾਬ ਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਮਾਝ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ ਕਿ ਸਾਨੂੰ ਸਾਡੀ ਮਾਝੀ ਬੋਲੀ ਮਤਲਬ ਮਲਵਈ ਮਾਝੀ ਬੋਲੀ ਬੋਲ ਸਕਦੇ ਹਾਂ